ਰੂਪਨਗਰ ਜ਼ਿਲ੍ਹੇ ਵਿੱਚ ਖੇਤੀਬਾੜੀ ਉਤਪਾਦ ਖੇਤੀ ਅਭਿਆਸ ਨੂੰ ਲੈ ਕੇ ਫਸਲਾਂ ਪੈ ਜਿਵੇਂ ਕਿਸਾਨ ਪਹਿਲਾਂ ਹੱਥਾਂ ਨਾਲ ਮਿਹਨਤ ਕਰਦੇ ਹੁੰਦੇ ਸਨ ਅਤੇ ਹੁਣ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਹੈ ਕਿ ਹੁਣ ਕਿਸਾਨ ਸਾਰਾ ਕੰਮ ਮਸ਼ੀਨਾਂ ਨਾਲ ਹੀ ਕਰਨ ਲੱਗ ਪਏ ਹਨ ਜੇ ਇਸ ਤੋਂ ਬਾਅਦ ਜੇ ਸਿੰਚਾਈ ਦੀ ਵਰਤੋਂ ਕਰੀਏ ਤਾਂ ਸਿੰਚਾਈ ਵਿੱਚ ਪਾਣੀ ਦਾ ਸੋਮਾ ਟਿਊਬਵੈੱਲ ਹੈ ਅਤੇ ਫਸਲਾਂ ਦੀ ਟੈਕਨੋਲੋਜੀ ਬਹੁਤ ਵੱਧ ਗਈ ਹੈ ਪੰਜਾਬ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਵਧੇਰੇ ਕਿਸਾਨ ਪਸ਼ੂ ਵੀ ਰੱਖਦੇ ਹਨ ਅਤੇ ਆਪਣਾ ਗੁਜ਼ਾਰਾ ਕਰਦੇ ਹਨ